ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਸਵੀਗੀ ਏਜੰਟ ਬੋਲ ਰਹੇ ਹਾਂਜੀ ਹਾਂਜੀ ਭਾਅ ਜੀ ਮੈਨੂੰ ਨਾ ਇੱਕ ਪ੍ਰੋਬਲਮ ਆ ਰਹੀ ਸੀਗੀ ਹਾਂਜੀ ਮੈਂ ਔਡਰ ਕੀਤਾ ਸੀ ਇੱਥੋਂ ਹਿਮਾਲਿਆ ਬੇਕਰੀ ਤੋਂ ਅਤੇ ਮੈਂ ਪੇਮੈਂਟ ਕਰ ਤੀ ਔਨਲਾਈਨ ਮੇਰੇ ਤਾਂ ਹੋ ਗਿਆ ਇੱਥੇ ਪ੍ਰੋਸੀਡ ਹੋ ਗਿਆ ਮੇਰੇ ਹਾਂਜੀ ਸ਼ੋਅ ਹੋ ਰਹੀ ਹੈ ਕਿ ਹੋ ਗਏ ਹੈ ਮਤਲਬ ਪ੍ਰੋਸੀਡ ਪੇਮੈਂਟ ਬਟ ਉੱਥੇ ਸਵੀਗੀ 'ਤੇ ਨਹੀਂ ਸ਼ੋਅ ਹੋ ਰਿਹਾ ਮੇਰੇ ਅਕਾਉਂਟ 'ਚੋਂ ਪੈਸੇ ਕੱਟ ਗਏ ਹੈ ਹਾਂਜੀ ਹਾਂਜੀ ਹਾਂਜੀ ਮੇਰੀ ਔਡਰ ਆਈ ਡੀ ਤਿੰਨ ਜੀਰੋ ਸੱਤ ਅੱਠ ਦੋ ਪੰਜ ਇੱਕ ਇੱਕ ਸੱਤ ਜਿਹਦੇ 'ਚ ਮੈਂ ਇੱਕ ਲਾਰਜ ਸਾਈਜ਼ ਦਾ ਫਾਰਮ ਫਰੈਸ਼ ਪੀਜ਼ਾ ਮੰਗਵਾਇਆ ਸੀ ਦੋ ਲੀਟਰ ਦੀ ਕੋਕ ਅਤੇ ਇੱਕ ਰੈਡ ਸੋਸ ਪਾਸਤਾ ਮੰਗਵਾਇਆ ਸੀ ਹਾਂਜੀ ਹਾਂਜੀ ਹਿਮਾਲਿਆ ਬੇਕਰਸ ਤੋਂ ਢਾਂਗੂ ਰੋਡ ਹਾਂਜੀ ਪਰ ਮੇਰਾ ਪ੍ਰੋਸੀਡ ਹੋ ਗਿਆ ਉੱਥੇ ਮੇਰੇ ਅਕਾਊਂਟ 'ਚੋਂ ਪੈਸੇ ਕੱਟ ਗਏ ਹੈ ਪਰ ਸਵੀਗੀ 'ਤੇ ਸ਼ੋਅ ਨਹੀਂ ਹੋ ਰਿਹਾ ਕਿ ਮੈਂ ਮੇਰੀ ਪੇਮੈਂਟ ਜਿਹੜੀ ਹੈਗੀ ਆ ਉਹ ਹੋ ਗਈ ਹੈ ਹਾਂਜੀ ਅਤੇ ਮੈਂ ਉਹੀ ਮੇਰਾ ਸਾਢੇ ਛੇ ਸੌ ਬਣਿਆ ਸੀਗਾ ਬਿੱਲ ਮਤਲਬ ਇੱਦਾਂ ਮੇਰਾ ਸਾਢੇ ਛੇ ਸੌ ਬਣਿਆ ਸੀ ਅਤੇ ਸੀ ਜੀ ਐਸ ਟੀ ਪਈ ਇੱਕੀ ਰੁਪਏ ਅਤੇ ਵੀਹ ਰੁਪਏ ਉੱਨੀ ਰੁਪਏ ਜੀ ਐਸ ਟੀ ਪਈ ਅਤੇ ਟੋਟਲ ਮੇਰਾ ਛੇ ਸੌ ਨੱਬੇ ਬਿੱਲ ਬਣਿਆ ਸੀ ਹਾਂਜੀ ਹਾਂਜੀ ਅਤੇ ਮੈਂ ਤਾਂ ਉੱਥੋਂ ਕਰ ਤੀ ਪ੍ਰੋਸੀਡ ਮੇਰੇ ਗੂਗਲ ਪੇਅ ਤੋਂ ਪ੍ਰੋਸੀਡ ਹੋ ਗਈ ਮੈਂ ਗੂਗਲ ਪੇਅ ਤੋਂ ਕੀਤੀ ਸੀ ਪੇਮੈਂਟਸ ਅਤੇ ਸਵੀਗੀ 'ਤੇ ਹਜੇ ਪ੍ਰੋਸੀਡ ਨਹੀਂ ਹੋਈ ਹਾਂਜੀ ਅਤੇ ਤੁਸੀਂ ਮੈਨੂੰ ਦੇਖ ਕੇ ਦੱਸ ਸਕਦੇ ਹੋ ਕਿ ਮੇਰੀ ਪੇਮੈਂਟ ਹੋ ਗਈ ਪ੍ਰੋਸੀਡ ਕਿ ਨਹੀਂ ਹਾਂਜੀ ਹਾਂਜੀ ਮਿਹਰਬਾਨੀ ਭਾਅ ਜੀ ਵੇਖ ਕੇ ਦੱਸੋ ਹਾਂਜੀ ਹਾਂਜੀ ਭਾਅ ਜੀ ਹਾਂਜੀ ਨਹੀਂ ਹੋਈ ਅਜੇ ਪਰ ਭਾਅ ਜੀ ਮੇਰੇ ਇੱਥੋਂ ਤਾਂ ਹੋ ਗਈ ਨਾ ਮੇਰੇ ਅਕਾਊਂਟ 'ਚ ਪੈਸੇ ਕੱਟ ਗਏ

ਹਾਂਜੀ ਮੇਰੀ ਟ੍ਰਾਂਜੈਕਸ਼ਨ ਆਈ ਡੀ 'ਤੇ ਮੈਂ ਕਰੀਬ ਕੀਤੇ ਛੇ ਪੱਚੀ 'ਤੇ ਕੀਤੀ ਆ ਮੈਂ ਹਾਂਜੀ ਗੂਗਲ ਪੇਅ ਤੋਂ ਕੀਤੀ ਮੈਂ ਅਤੇ ਮੇਰੇ ਅਕਾਊਂਟ 'ਚ ਪੈਸੇ ਕੱਟ ਹੋ ਗਏ ਹੈ ਪਰ ਸਵੀਗੀ 'ਤੇ ਨਹੀਂ ਹੋ ਰਹੇ ਹਾਂਜੀ ਅਤੇ ਟ੍ਰਾਂਜੈਕਸ਼ਨ ਆਈ ਡੀ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਇਹੀ ਨੰਬਰ ਤੁਹਾਡਾ ਵਟਸਐਪ ਵਾਲਾ

ਚਲੋ ਠੀਕ ਆ ਭਾਅ ਜੀ ਤੁਸੀਂ ਮੈਨੂੰ ਫਿਰ ਦੇਖ ਕੇ ਦੱਸ ਦੋ ਤੇ ਜੇ ਹੋ ਗਈ ਐ ਤੇ ਫਿਰ ਪ੍ਰੋਸੀਡ ਕਰ ਦਿਓ ਹਾਂਜੀ ਮੈਨੂੰ ਇਨਫੋਰਮ ਕਰ ਦਿਓ ਇੱਕ ਵਾਰ ਕਿਉਂਕਿ ਮੇਰੇ ਅਕਾਊਂਟ 'ਚੋਂ ਪੈਸੇ ਕੱਟ ਹੋ ਗਏ ਹੈ ਅਤੇ ਸਵੀਗੀ ਤੋਂ ਹਜੇ ਪ੍ਰੋਸੀਡ ਨਹੀਂ ਹੋਈ ਹਾਂਜੀ ਹਾਂਜੀ ਥੈਂਕ ਯੂ ਭਾਅ ਜੀ